ਭੰਗੜੇ ਦੇ ਕੁਝ ਆਪ ਆਮ ਸਟੈਪ ਮੂਰਾਂ ਵਾਲੀ ਚਾਲ ਮੁਗੇਰ ਆਦਿ ਹਨ ਪੰਜਾਬੀ ਸੱਭਿਆਚਾਰ ਦੇ ਜ਼ੋਰਦਾਰ ਅਤੇ ਜਸ਼ਨ ਵਾਲੇ ਸੁਭਾਅ ਵਿੱਚ ਭੰਗੜਾ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਭੰਗੜਾ ਪਾਉਣ ਨਾਲ ਸਾਰੇ ਸਰੀਰ ਦੀ ਕਸਰਤ ਹੋ ਜਾਂਦੀ ਹੈ ਅਤੇ ਇਸਨੂੰ ਖ਼ਾਸ ਕਰਕੇ ਵਿਸਾਖੀ ਵਾਲੇ ਦਿਨ ਬਹੁਤ ਜੋਸ਼ ਨਾਲ ਪਾਇਆ ਜਾਂਦਾ ਹੈ ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਮਹੱਤਤਾ ਹੈ ਜਦੋਂ ਨੌਜਵਾਨ ਜੋਸ਼ ਨਾਲ ਭੰਗੜਾ ਪਾਉਂਦੇ ਹਨ ਉਦੋਂ ਸਾਰੇ ਲੋਕ ਖੜ ਖੜ ਕੇ ਵੇਖਦੇ ਹਨ ਅਤੇ ਉਹਨਾਂ ਦੇ ਇਸ ਟੈਲੈਂਟ ਨੂੰ ਬਹੁਤ ਸਲਾਉਂਦੇ ਹਨ